ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਠੀਕ ਹੈ ਸਰ ਬੋਲੋ ਜੀ ਅੱਛਾ ਸਰ ਕੋਈ ਗੱਲ ਕੋਈ ਗੱਲ ਠੀਕ ਹੈ ਸਰ ਟਿਊਸ਼ਨ 'ਤੇ ਲਗਵਾ ਦਿੰਦੇ ਆ ਜੀ ਅੱਛਾ ਸਰ ਠੀਕ ਆ ਜੀ

ਹਾਂਜੀ ਸਰ ਠੀਕ ਹੈ ਸਰ ਹਾਂਜੀ ਸਰ ਹਾਂਜੀ ਸਰ ਹਾਂਜੀ ਸਰ ਇਹ ਥੋੜ੍ਹਾ ਜਿਹਾ ਮੈਥ 'ਚ ਵੀਕ ਆ ਅੱਛਾ ਸਰ ਵੈਸੇ ਇਹ ਤੋਂ ਟੇਬਲ ਟੂਬਲ ਸੁਣਿਆ ਕਰੋ ਸਰ ਅੱਛਾ ਸਰ ਅੱਛਾ ਜੀ ਹਾਂਜੀ ਸਰ ਠੀਕ ਹੈ ਸਰ ਠੀਕ ਠੀਕ ਹੈ ਜੀ ਠੀਕ ਹੈ ਜੀ ਘਰ ਲਗਵਾ ਲਿਆ ਕਰਾਂਗੇ ਜੀ

ਅੱਛਾ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਸਰ ਓ ਓਕੇ ਜੀ ਬਾਏ